ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਠੀਕ ਹੈ ਜੀ ਠੀਕ ਹੈ ਠੀਕ ਠੀਕ ਹੈ ਜੀ ਹਾਂਜੀ ਲੈ ਤਾਂ ਲੈਂਦੇ ਹਾਂ ਬਟ ਕੰਡੀਸ਼ਨ ਵੇਖ ਕੇ ਉਹਦਾ ਐਡੀਸ਼ਨ ਦੇਖ ਲੈਂਦੇ ਹਾਂ ਕਿਉਂਕਿ ਸਲੇਬਸ ਹਰ ਈਅਰ ਜਿਹੜਾ ਉਹ ਚੇਂਜ ਹੁੰਦਾ ਹੈ ਅਤੇ ਉਸ ਅਕੋਡਿੰਗ ਤੁਸੀਂ ਮੈਨੂੰ ਦੱਸ ਦਿਓ ਆਪਣੀ ਬੁੱਕ ਲਿਸਟ ਕੀ ਕੀ ਹੈ ਕੀ ਹੈ ਕੰਡੀਸ਼ਨ ਕਿਵੇਂ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਦੇਖੋ ਪਹਿਲਾਂ ਤਾਂ ਅਸੀਂ ਕੰਡੀਸ਼ਨ ਦੇਖਦੇ ਹਾਂ ਬੁੱਕ ਦੀਆਂ ਫਿਰ ਐਡੀਸ਼ਨ ਜੇ ਐਡੀਸ਼ਨ ਤੁਹਾਡਾ ਲੇਟੈਸਟ ਹੈ ਮੰਨ ਲਓ ਦੋ ਹਜ਼ਾਰ ਪੱਚੀ ਚੱਲ ਰਿਆ ਹੈ ਨਾ ਤਾਂ ਤੇਈ ਚੌਵੀ ਵਾਲਾ ਐਡੀਸ਼ਨ ਅਸੀਂ ਲੇਟੈਸਟ ਹੀ ਮੰਨਦੇ ਹਾਂ ਅਤੇ ਉਹ ਜਿਵੇਂ ਪ੍ਰਿੰਟ ਰੇਟ ਤੋਂ ਆਪਾਂ ਲਵਾਂਗੇ ਫਿਫਟੀ ਪਰਸੈਂਟ 'ਤੇ ਹਾਫ਼ ਰੇਟ 'ਤੇ ਹਾਂਜੀ ਅਤੇ ਜੇ ਕੰਡੀਸ਼ਨ ਠੀਕ ਨਹੀਂ ਹੈ ਤਾਂ ਕਈ ਵਾਰ ਇੱਦਾਂ ਹੁੰਦਾ ਵੀ ਅਸੀਂ ਕੰਡੀਸ਼ਨ ਜੇ ਮਾੜੀ ਹੋਵੇ ਫਿਰ ਉਹ ਸੇਲ ਨਹੀਂ ਹੁੰਦੀ ਸਾਡੇ ਅਤੇ ਜੇ ਕੰਡੀਸ਼ਨ ਠੀਕ ਹੈਗੀ ਹੈ ਫਿਰ ਫਿਫਟੀ ਪਰਸੈਂਟ 'ਤੇ ਅਸੀਂ ਰੱਖਲਾਂਗੇ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਨਹੀਂ ਸੌਰੀ ਸਰ ਸਾਡਾ ਇਹ ਇੱਕ ਰੂਲ ਹੈ ਮਤਲਬ ਜੋ ਸਟਾਟਿੰਗ ਅਸੀਂ ਰੇਟ ਫਿਕਸ ਕਰਤਾ ਹੈ ਨਾ ਕਿਉਂਕਿ ਹੋਰ ਵੀ ਬਹੁਤ ਸਾਰੀਆਂ ਸ਼ੋਪਸ ਹੈਗੀਆਂ ਹੈ ਅਤੇ ਉਹ ਸਾਡਾ ਆਪਸ 'ਚ ਮਤਲਬ ਕੀ ਇੱਦਾਂ ਹੁੰਦਾ ਵੀ ਅਸੀਂ ਫਿਫਟੀ ਪਰਸੈਂਟ 'ਤੇ ਹੀ ਰੱਖਣੀ ਹੈ ਚੱਲੋ ਕੋਈ ਗੱਲ ਨਹੀਂ ਵੈਸੇ ਤਾਂ ਅਸੀਂ ਮਤਲਬ ਸ਼ੁਰੂ ਤੋਂ ਹਰ ਕਸਟਮਰ ਨਾਲ ਇੱਕੋ ਵਰਗਾ ਹੀ ਡੀਲ ਕਰੀ ਦਾ ਹੈ ਅਤੇ ਜੇ ਤੁਸੀਂ ਤੁਹਾਡੇ ਕਹਿਣ ਦੇ ਅਕੋਡਿੰਗ ਵੀ ਬੁਕਸ ਦੀ ਕੰਡੀਸ਼ਨ ਮੈਮ ਬਹੁਤ ਅੱਛੀ ਹੈ ਅਤੇ ਉਸ ਅਕੋਡਿੰਗ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਅਤੇ ਕਿਉਂਕਿ ਜੋ ਗੱਲ ਆਪਾਂ ਕਹਿ ਰਹੇ ਹਾਂ ਹੈ ਨਾ ਜੋ ਦੇਖਾਂਗੇ ਫਿਰ ਹੀ ਆਪਾਂ ਨੂੰ ਕੰਡੀਸ਼ਨ ਪਤਾ ਲੱਗੇਗਾ ਕਿਉਂਕਿ ਸਾਨੂੰ ਸਾਡੀ ਸੈਲਿੰਗ ਦਾ ਪਤਾ ਹੁੰਦੀ ਵੀ ਕਿੱਦਾਂ ਦੀਆਂ ਸੇਲਸ ਹੁੰਦੀਆਂ ਹੈ ਬੱਚੇ ਕਿਉਂਕਿ ਜ਼ਿਆਦਾ ਉਹਨਾਂ ਦੀ ਹਾਲਤ ਖਰਾਬ ਹੋਵੇ ਫਿਰ ਉਹ ਲੈਂਦੇ ਹੀ ਨਹੀਂ ਗੇ ਤਾਂ ਫਿਰ ਸਾਨੂੰ ਫੋਟੀ ਫਿਫਟੀ ਪਰਸੈਂਟ ਪਰ ਐਂ ਵੀ ਸਾਡੇ ਲਈ ਵੇਸਟ ਹੈ ਅਤੇ ਇਸ ਕਰਕੇ ਨਾ ਤੁਸੀਂ ਕੱਲ੍ਹ ਤਾਂ ਹੈਗਾ ਸੰਡੇ ਅਤੇ ਤੁਸੀਂ ਕੱਲ੍ਹ ਮੰਡੇ ਨੂੰ ਆ ਕੇ ਤੁਸੀਂ ਜਿਹੜੇ ਟਾਈਮ ਵੀ ਤੁਸੀਂ ਆਉਣਾ ਚਾਹੁੰਦੇ ਹੋ ਆ ਸਕਦੇ ਹੋ ਸ਼ੋਪ ਨੌਂ ਵਜੇ ਨੀਅਰ ਅਬਾਊਟ ਓਪਨ ਹੋ ਜਾਂਦੀ ਹੈ ਹਾਂਜੀ ਪਰ ਸੁਬਹ ਸੁਬਹ ਥੋੜ੍ਹਾ ਤੁਸੀਂ ਅਵੋਆਇਡ ਹੀ ਕਰਿਓ ਕਿਉਂਕਿ ਹਾਂਜੀ ਸਕੂਲ ਵਗੈਰਾ ਦਾ ਰਸ਼ ਬਹੁਤ ਹੁੰਦਾ ਕਈ ਵਾਰ ਨੋਟਬੂਕਸ ਪੈੱਨ ਲਈ ਸਟੇਸ਼ਨਰੀ ਲਈ ਤਾਂ ਤੁਸੀਂ ਗਿਆਰਾਂ ਕੁ ਵਜੇ ਦਾ ਟਾਈਮ ਰੱਖੋ ਤਾਂ ਕਿ ਮੈਂ ਵੀ ਤੁਹਾਨੂੰ ਟਾਈਮ ਦੇ ਸਕਾਂ ਦੇਖ ਸਕਾਂ ਬੁੱਕ ਤੁਹਾਡੇ ਮਤਲਬ ਕਿ ਕਿਵੇਂ ਹੈ ਹਾਂਜੀ ਹਾਂਜੀ ਤਾਂ ਕੋਈ ਗੱਲ ਨਹੀਂ ਤੁਸੀਂ ਮੰਡੇ 'ਤੇ ਹੀ ਰੱਖ ਲਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਪਰ ਜੋ ਆਪਣਾ ਰੇਟ ਹੈਗਾ ਲੱਗੇਗਾ ਤਾਂ ਉਹ ਹੀ ਵੀ ਹਾਫ਼ 'ਤੇ ਹੀ ਮਤਲਬ ਉਸ ਅਕੋਡਿੰਗ ਤੁਸੀਂ ਲੈ ਕੇ ਆਏ ਹੋ ਨਾ ਇਹ ਨਾ ਹੋਵੇ ਭਾਰ ਚੁੱਕੋ ਕਿਉਂਕਿ ਰੂਲਸ ਐਂਡ ਰੇਗੁਲੇਸ਼ਨਸ ਹਰ ਸ਼ੋਪ 'ਤੇ ਹੁੰਦੀ ਹੈ ਹੈ ਨਾ ਅਤੇ ਤੁਸੀਂ ਫਿਫਟੀ ਪਰਸੈਂਟ 'ਤੇ ਆਪਾਂ ਰੱਖਲਾਂਗੇ ਜੇ ਕੋਈ ਕੰਡੀਸ਼ਨ ਨਾ ਸਹੀ ਲੱਗੀ ਕੋਈ ਗੱਲ ਨਹੀਂ ਕੋਈ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਕੋਈ ਗੱਲ ਨਹੀਂ ਜੀ ਤੁਸੀਂ ਮੌਸਟ ਵੈਲਕਮ ਜਦੋਂ ਮਰਜ਼ੀ ਵਿਜਿਟ ਕਰ ਸਕਦੇ ਹੋ ਓ ਓਕੇ ਜੀ ਓਕੇ ਥੈਂਕ ਉ